ਪਰਸ ਥੋੜ੍ਹਾ ਕੋਸਟਲੀ ਸੀ ਪਰ ਓਹਦੇ ਵਿੱਚ ਇੱਕ ਨੇਗਟਿਵ ਚੀਜ਼ ਸੀ ਵੀ ਇ ਇੱਕ ਓਪਨ ਪੋਕਟ ਸੀ ਓਹਦੀ ਓਹ ਮੈਨੂੰ ਥੋੜ੍ਹਾ ਤੰਗ ਕਰਦੀ ਸੀ ਜਿਵੇਂ ਸਮਾਨ ਨਿਕਲ ਕੇ ਬਹਾਰ ਡਿੱਗ ਜਾਂਦਾ ਸੀ